ਉਹ ਰੁਟੀਨ ਜਾਣੀ ਕਿ ਜਦੋਂ ਮੈਂ ਸਵੇਰੇ ਨੂੰ ਸਾਜਰੇ ਉੱਠਦਾ ਜਾਂ ਦੁੱਧ ਸ਼ੇਕ ਪੀ ਕੇ ਫਿਰ ਆਪਣੀ ਰਨਿੰਗ ਸਟਾਰਟ ਕਰਦਾ ਸਰੀਰ ਦੀ ਇਸ ਨਾਲ ਸਰੀਰ ਸਾਡਾ ਸਹੀ ਰਹਿੰਦਾ ਸਾਰੀ ਦਿਹਾੜੀ ਫਿਟ ਐਂਡ ਫਿਟ ਫਾਟ ਰਹਿੰਦਾ ਜਿਹਦੇ ਨਾਲ ਮੈਂ ਬਹੁਤ ਮੁਕਾਬਲੇ ਜਿਵੇਂ ਰੱਸੀ ਖਿੱਚਣਾ ਅਤੇ ਰੱਸੀ ਨੂੰ ਫੜ ਕੇ ਉੱਪਰ ਚੜਨਾ ਵੀ ਪਕੜ ਮਜਬੂਤ ਸਰੀਰ ਦੀ ਲਚਕਵਾਨ ਵੀ ਹੋਰ ਕਈ ਗੁਡ ਐਕਟੀਵਿਟੀਜ ਵੀ ਆਪਣਾ ਸਰੀਰ ਸੈੱਟ ਰਹੇ ਇਹਦੇ ਨਾਲ ਕੀ ਹੁੰਦਾ ਮੈਂ ਸਰੀਰ ਦੀ ਜਾਂ ਆਪ ਮਾਲਿਸ਼ ਕਰਨੀ ਦੋ ਟਾਈਮ ਸਵੇਰ ਨੂੰ ਵੀ ਦੁਪਹਿਰ ਨੂੰ ਵੀ ਸ਼ਾਮ ਨੂੰ ਵੀ ਸਰੀਰ ਦੀ ਐਨ ਮਾਲਿਸ਼ ਚੰਗੀ ਤਰ੍ਹਾਂ ਤੇਲ ਤੂਲ ਮਲ ਕੇ ਐਨ ਸਰੀਰ ਸੈੱਟ ਰਹਿੰਦਾ ਹੈ ਜਿਹਦੇ ਨਾਲ ਮੰਮੀ ਜਾਂ ਆਪ ਵੀ ਜਾਂ ਮਾਤਾ ਤੋਂ ਵੀ ਮਲਾ ਲੈਂਦਾ ਹਾਂ ਮੈਂ ਜਿਹਦੇ ਨਾਲ ਸਾਰੀ ਦਿਹਾੜੀ ਸਰੀਰ ਵੀ ਸੈੱਟ ਰਹਿੰਦਾ ਸਰੀਰ ਦੀ ਲਾਲਚ ਵੀ ਵੱਧਦੀ ਹੈ ਸਰੀਰ ਮਜਬੂਤ ਵੀ ਹੁੰਦਾ ਆਪਣਾ ਵੱਧ ਤੋਂ ਵੱਧ ਜਿੰਨਾ ਮਜਬੂਤ ਹੋਵੇਗਾ ਉਹਦਾ ਬੈਨੀਫਿਟ ਹੁੰਦਾ ਸਰੀਰ